ਸਾਡਾ ਮਨਪਸੰਦ ਪੰਜਾਬੀ ਦਾ ਜੋ ਗੁਰੂਆਂ ਦਾ ਬਖਸ਼ਿਆ ਫਤਿਹ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਸਿੱਖ ਦੂਜੇ ਸਿੱਖ ਨੂੰ ਮਿਲਦਾ ਇਹੀ ਜੈਕਾਰਾ ਬੁਲਾਉਂਦਾ ਕਿ ਉਹਦਾ ਇਹਦੇ ਵਿਚ ਹੀ ਮਾਨ ਸਨਮਾਨ ਹੁੰਦਾ ਅਸੀਂ ਸੁਬਾ ਸ਼ਾਮ ਆਥਣ ਵੇਲੇ ਪਾਠ ਵਗੈਰਾ ਕਰਦੇ ਹਾਂ ਜੋ ਕਿ ਸਾਡਾ ਪੰਜਾਬੀ ਦੇ ਵਿੱਚ ਸਾਨੂੰ ਪੜ੍ਹਨ ਦੇ ਵਿੱਚ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਅਤੇ ਅਸੀਂ ਮਾਂ ਬੋਲੀ ਪੰਜਾਬੀ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਪੜ੍ਹਦੇ ਹਾਂ